ਪ੍ਰਦੂਸ਼ਣ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਖੇਤਰਾਂ ਵਿੱਚ ਬਹੁਤ ਹੀ ਜ਼ਿਆਦੇ ਪੋਲਿਊਸ਼ਨ ਫੈਲਿਆ ਹੋਇਆ ਹਨ ਜੋ ਕਿ ਟ੍ਰੈਫਿਕ ਗੱਡੀਆਂ ਮੋਟਰਸਾਈਕਲ ਕਾਰਾਂ ਆਦਿ ਨਾਲ਼ ਫੈਲਿਆ ਹੋਇਆ ਹੈ ਅਤੇ ਸਾਡੇ ਨੇੜੇ ਫੈਕਟਰੀਆਂ ਕੈਮੀਕਲ ਪਲਾਂਟ ਦੇ ਟੂਆਂ ਧੂੰਆਂ ਨਾਲ਼ ਸਾਡਾ ਜੋ ਕਿ ਆਸਮਾਨ ਸਾਨੂੰ ਕਲੀਅਰ ਨਹੀਂ ਦਿਖਦਾ ਹੈ ਇਹ ਸਾਨੂੰ ਉਦੋਂ ਹੀ ਸਾਫ ਦਿਖਦਾ ਹੈ ਜਦੋਂ ਵਰਖਾ ਹੁੰਦੀ ਹੈ ਮੀਂਹ ਪੈਣ ਕਾਰਨ ਮੌਸਮ ਜਿੰਨੀ ਧੂੰਆਂ ਉੱਪਰ ਉੱਠਿਆ ਹੁੰਦਾ ਹੈ ਫੈਕਟਰੀਆਂ ਦਾ ਗੱਡੀਆਂ ਦਾ ਮੋਟਰਸਾਈਕਲਾਂ ਦਾ ਇਹ ਸਾਰਾ ਨੀਚੇ ਬੈਠ ਜਾਂਦਾ ਆ ਤਾਂ ਜਿਹਦੇ ਕਰਕੇ ਸਾਨੂੰ ਤਾਰੇ ਐਨ ਕਲੀਅਰ ਮੌਸਮ ਰਾਤ ਨੂੰ ਵੀ ਐਨ ਕਲੀਅਰ ਸਾਫ਼ ਦਿਖਦਾ ਆ